ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅਤੇ ਅੱਜ ਮੈਂ ਤੁਹਾਡੇ ਨਾਲ ਆਪਣੇ ਮਨਪਸੰਦ ਅਖਬਾਰ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੀ ਵੈਸੇ ਤਾਂ ਅੱਜ ਕੱਲ ਬਹੁਤ ਸਾਰੀਆਂ ਅਖਬਾਰਾਂ ਆਉਂਦੀਆਂ ਹਨ ਜਿਵੇ ਕਿ ਦ ਹਿੰਦੁਸਤਾਨ ਟਾਈਮ ਦ ਟ੍ਰਿਬਿਊਨ ਦੈਨਿਕ ਭਾਸਕਰ ਦੈਨਿਕ ਜਾਗਰਨ ਪੰਜਾਬ ਕੇਸਰੀ ਅਤੇ ਆਦਿ ਇਹਨਾਂ ਵਿੱਚੋਂ ਮੇਰੀ ਮਨਪਸੰਦ ਅਖਬਾਰ ਪੰਜਾਬ ਕੇਸਰੀ ਹੈ ਕਿਉਂਕਿ ਇਸ ਵਿੱਚ ਪੰਜਾਬ ਦੇ ਹਰ ਕਸਬੇ ਹਰ ਜ਼ਿਲ੍ਹੇ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਖਬਰਾਂ ਆਉਂਦੀਆਂ ਹਨ ਇਸ ਦੇ ਨਾਲ ਇਸ ਵਿੱਚ ਦੇਸ਼ ਵਿੱਚ ਕੀ ਚੱਲ ਰਿਹਾ ਹੈ ਕਿੱਥੇ ਕੀ ਹੋ ਰਿਹਾ ਹੈ ਉਹ ਵੀ ਦੱਸਿਆ ਜਾਂਦਾ ਹੈ ਹੋਰ ਇੱਕ ਖਬਰ ਲਈ ਅਲੱਗ ਅਲੱਗ ਕੋਲਮ ਹੁੰਦੇ ਹਨ ਅਤੇ ਹਰ ਇੱਕ ਖਬਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਇਸ ਵਿੱਚ ਖਬਰਾਂ ਦੇ ਨਾਲ ਨਾਲ ਚੁਟਕਲੇ ਵੀ ਆਉਂਦੇ ਹਨ ਅਤੇ ਐਤਵਾਰ ਨੂੰ ਇਸ ਮਨੋਰੰਜਨ ਇੱਕ ਮਨੋਰੰਜਨ ਅਤੇ ਫਿਲਮੀ ਖਬਰਾਂ ਵਾਲਾ ਇੱਕ ਪੇਜ ਵੀ ਆਉਂਦਾ ਹੈ ਸਾਡੇ ਘਰ ਦਾ ਹਰ ਇੱਕ ਮੈਂਬਰ ਇਸ ਨੂੰ ਪੜ੍ਹਦਾ ਹੈ ਇਸ ਦੀ ਇੱਕ ਖਾਸੀਅਤ ਇਹ ਹੈ ਕਿ ਇਹ ਤਾਂ ਇੱਕ ਤਾਂ ਇਸਦੀ ਕੀਮਤ ਵੀ ਬਹੁਤ ਥੋੜ੍ਹੀ ਹੈ ਅਤੇ ਇਹ ਸਾਨੂੰ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ਧੰਨਵਾਦ